ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਤਜਿੰਦਰ ਸਿੰਘ ਗੱਲ ਕਰਦਾ ਪਿਆ ਵਾਂ ਮੈਂ ਕੁਝ ਦਿਨ ਪਹਿਲਾਂ ਤੁਹਾਡੇ ਕੋਲੋਂ ਇੱਕ ਮੋਬਾਈਲ ਫੋਨ ਪ੍ਰੋਡਕਟ ਬੁੱਕ ਕਰਵਾਇਆ ਸੀ ਜੋ ਮੈਨੂੰ ਪ੍ਰੋਡਕਟ ਮਿਲ ਤਾਂ ਗਿਆ ਪਰ ਜਿਹੜਾ ਮੋਬਾਈਲ ਫੋਨ ਜਿਹੜੇ ਕਲਰ ਦਾ ਮੈਂ ਬੁੱਕ ਕਰਵਾਇਆ ਸੀ ਆਡਰ ਉਹ ਕਲਰ ਉਹ ਡਿਫਰੈਂਟ ਕਲਰ ਦਾ ਆਇਆ ਹੈ ਮੈਂ ਬਲੈਕ ਕਲਰ ਦਾ ਆਡਰ ਬੁੱਕ ਕੀਤਾ ਸੀ ਪਰ ਤੁਸੀਂ ਗੋਲਡਨ ਸ਼ੇਡ ਦਾ ਜੋ ਮੋਬਾਈਲ ਫੋਨ ਉਹ ਪ੍ਰੋਡਕਟ ਭੇਜਿਆ ਮੇਰੇ ਕੋਲ ਅਤੇ ਨਾਲ ਜਦੋਂ ਮੈਂ ਪ੍ਰੋਡਕਟ ਦੇਖਿਆ ਸੀ ਤਾਂ ਉਸ ਦੇ ਵਿੱਚ ਡਾਟਾ ਕੇਵਲ ਅਤੇ ਜੋ ਕੰਡਕਟਰ ਸੀ ਉਹ ਵੀ ਤੁਸੀਂ ਦੇ ਰਹੇ ਸੀ ਨਾਲ ਪਰ ਜਦੋਂ ਮੈਂ ਡੱਬਾ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਇਕੱਲਾ ਮੋਬਾਇਲ ਫੋਨ ਹੀ ਮਿਲਿਆ ਸੋ ਮੈਂ ਇਹ ਜੋ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਤਾਂ ਮੋਬਾਇਲ ਫੋਨ ਦਾ ਜੋ ਕਲਰ ਹੈ ਉਹ ਡਿਫਰੈਂਟ ਆਇਆ ਅਤੇ ਉਸ ਦੀ ਬੈਟਰੀ ਪਿਕਅਪ ਵੀ ਜਿੰਨੀ ਦੱਸੀ ਗਈ ਸੀ ਉਹ ਇੰਨਾ ਟਾਈਮ ਨਹੀਂ ਕੱਢਦਾ ਅਤੇ ਨਾਲ ਹੀ ਅਡਾਪਟਰ ਅਤੇ ਜੋ ਯੂ ਐੱਸ ਬੀ ਡਾਟਾ ਕੇਬਲ ਹੈ ਉਹ ਵੀ ਮੈਨੂੰ ਨਾਲ ਨਹੀਂ ਮਿਲੀ